ਭੰਗੜਾ ਮੈਂ ਖੁਦ ਇੱਕ ਪੰਜਾਬੀ ਹਾਂ ਅਤੇ ਮੈਨੂੰ ਭੰਗੜੇ ਪਾਉਣ ਦਾ ਤਾਂ ਬਿਲਕੁਲ ਸ਼ੌਂਕ ਹੈ ਅਤੇ ਮੈਂ ਬਹੁਤ ਹੀ ਵਧੀਆ ਤਰੀਕੇ ਨਾਲ ਤਾਂ ਨੀ ਨਹੀਂ ਕਹਿ ਸਕਦਾ ਪਰ ਆਪਣੇ ਜੋਸ਼ ਅਤੇ ਵਧੀਆ ਤਰੀਕੇ ਕਾਰਨ ਭੰਗੜਾ ਜ਼ਰੂਰ ਪਾਉਂਦਾ ਹਾਂ ਅਤੇ ਮੈਂ ਇੱਕ ਆਪਣੇ ਕਾਲਜ ਵਿੱਚ ਪੜ੍ਹਦਾ ਹੁੰਦਾ ਸੀ ਅਤੇ ਯਾਰਾ ਦੋਸਤਾਂ ਨਾਲ ਜਾ ਹਾਸੀ ਮਜ਼ਾਕ ਵਿੱਚ ਮੈਂ ਭੰਗੜਾ ਪਾ ਰਿਹਾ ਸੀ ਅਤੇ ਤਦੋਂ ਮੇਰੇ ਇੱਕ ਟੀਚਰ ਨੇ ਮੈਨੂੰ ਦੇਖ ਲਿਆ

ਬਣਾ ਦਿੱਤਾ ਅਤੇ ਮੈਨੂੰ ਬਾਅਦ ਵਿੱਚ ਉਸ ਟੀਮ ਦਾ ਕਪਤਾਨ ਵੀ ਬਣਾ ਦਿੱਤਾ ਜਿਸ ਕਰਕੇ ਮੈਂ ਉਸ ਟੀਮ ਨੂੰ ਲੀਡ ਕੀਤਾ ਅਤੇ ਅਸੀਂ ਭੰਗੜੇ ਦੀ ਪ੍ਰੈਕਟਿਸ ਨੂੰ ਸ਼ੁਰੂ ਕਰ ਦਿੱਤਾ ਅਤੇ ਵੱਖ ਵੱਖ ਨਵੇਂ ਜਿਹੜੇ ਅਸੀਂ ਸਟੈਪ ਵੀ ਸਿੱਖੇ ਹਨ ਜਿਸ ਨਾਲ ਸਾਡਾ ਭੰਗੜਾ ਹੋਰ ਵੀ ਬਿਹਤਰੀਨ ਅਤੇ ਵੱਖਰੇ ਢੰਗ ਨਾਲ ਹੋ ਗਿਆ ਅਤੇ ਅਸੀਂ ਇਸ ਕਲਾਸ ਵਿੱਚੋਂ ਕੁਝ ਆਪਣੇ ਹਸੀ ਮਜ਼ਾਕ ਮਸਤੀ ਕਰਦੇ ਹੋਏ ਆਪਣੀ ਡੇਲੀ ਹਰ ਰੋਜ਼ ਜਿਹੜੇ ਭੰਗੜੇ ਦੀ ਤਿਆਰੀ ਕਰਦੇ ਸਨ ਅਤੇ ਆਪਣੇ ਲਾਸਟ ਯੂਥ ਫੈਸਟੀਵਲ ਦਿਨ ਅਸੀਂ ਆਪਣੇ ਪੂਰੇ ਜੋਸ਼ ਅਤੇ ਮਨ ਨਾਲ ਅਸੀਂ ਭੰਗੜਾ ਪਾਇਆ ਅਤੇ ਕਾਲਜ ਨੂੰ ਅਸੀਂ ਇੱਕ ਖਿਤਾਬ ਵੀ ਲੈ ਕੇ ਜਿੱਤਿਆ ਅਤੇ ਇਸ ਵਿੱਚ ਸਾਨੂੰ ਬੜਾ ਹੀ ਮਾਣ ਹੋਇਆ ਅਤੇ ਮੈਨੂੰ ਆਪਣਾ ਹੈ ਕਿ ਮੈਂ ਜੋ ਆਪਾਂ ਨੂੰ ਕੁਛ ਨਹੀਂ ਸਮਝਦੇ ਅਤੇ ਮਤਲਬ ਮੈਂ ਯਕੀਨ ਨਹੀਂ ਹੁੰਦਾ ਕਿ ਅਸੀਂ ਵੀ ਇਹ ਕੰਮ ਕਰ ਸਕਦੇ ਹਨ ਅਤੇ ਭੰਗੜੇ ਦੀ ਕਲਾਸ ਲਾ ਕੇ ਮੈਨੂੰ ਖ਼ੁਦ 'ਤੇ ਅੱਜ ਵੀ ਮੈਂ ਉਂਝ ਉਹਨਾਂ ਕਲਾਸਾਂ ਦਿਨਾਂ ਨੂੰ ਚੇਤੇ ਕਰਦਾ ਹਾਂ ਕੀ ਜਦੋਂ ਕਿਵੇਂ ਸਾਡੇ ਸਰ ਕਹਿੰਦੇ ਕੀ ਕਦੇ ਆਪਣੇ ਆਪ ਨੂੰ ਕਮੀਆਂ 'ਚ ਨਾ ਦੇਖੋ ਅਤੇ ਹਾਰ ਨਾ ਮੰਨੋ ਹਰ ਬੰਦੇ ਦੇ ਇੱਕ ਟੈਲੈਂਟ ਜ਼ਰੂਰ ਹੁੰਦਾ ਹੈ ਅਤੇ ਤੁਸੀਂ ਉਸੇ ਟੈਲੈਂਟ ਵਿੱਚ ਤੁਸੀਂ ਜਿਹੜੇ ਅੱਗੇ ਵੱਧ ਸਕਦੇ ਹੋ ਅਤੇ ਮੈਂ ਆਪਣੀ ਕਲਾਸ ਵਿੱਚ ਅੰਤ ਵਿੱਚ ਇਹੀ ਕਹਿਣਾ ਚਾਹੁੰਦਾ ਹਾਂ ਕਿ ਭੰਗੜੇ ਦੀ ਵਜ੍ਹਾ ਨਾਲ ਅੱਜ ਮੈਂ ਇੱਕ ਬਹੁਤ ਹੀ ਵਧੀਆ ਜਿਹੜਾ ਕਿ ਕਾਮਯਾਬੀ ਦੇ ਨਾਲ ਹਾਸਲ 'ਤੇ ਪੁੱਜਿਆ ਹਾਂ ਕਿਉਂਕਿ ਇ ਇਸ ਦੇ ਨਾਲ ਹੀ ਮੇਰਾ ਜਿਹੜਾ ਹੈ ਮੇਰੀ ਜੋਬ ਦਾ ਜਿਹੜਾ ਕਨਫਰਮੇਸ਼ਨ ਹੋਇਆ ਹੈ